ਮੇਰੀ ਜ਼ਿੰਦਗੀ ਦਾ ਸਭ ਤੋਂ ਇੱਕ ਮਹੱਤਵਪੂਰਨ ਫੈਸਲਾ ਜੋ ਰਿਹਾ ਹੈ ਉਹ ਹੈ ਮੇਰਾ ਵਿਆਹ ਤੋਂ ਬਾਅਦ ਪੜ੍ਹਨ ਦਾ ਫੈਸਲਾ ਇਹਦੇ ਲਈ ਜੋ ਮੈਨੂੰ ਪ੍ਰੇਰਨਾ ਦਿੱਤੀ ਸੀਗੀ ਮੇਰੇ ਪਤੀ ਨੇ ਔਰ ਮੇਰੀ ਸੱਸ ਮਾਂ ਨੇ ਪ੍ਰੇਰਨਾ ਦਿੱਤੀ ਸੀ ਕਿ ਮੈਂ ਜਿਸ ਤਰ੍ਹਾਂ ਐੱਮ ਏ ਹਿੰਦੀ ਕੀਤੀ ਹੈ ਤਾਂ ਕਿਉਂ ਨਾ ਬੀ ਐਡ ਕਰਾਂ ਅਤੇ ਪੜ੍ਹ ਲਿਖ ਕੇ ਸਕੂਲ ਜਾਂ ਕੋਲਜ 'ਚ ਪੜ੍ਹਾਵਾ ਉਸ ਟਾਈਮ ਮੈਨੂੰ ਲੱਗ ਰਿਹਾ ਸੀ ਕਿਤੇ ਨਾ ਕਿਤੇ ਕਿ ਮੇਰੇ 'ਚ ਵਿਸ਼ਵਾਸ ਘੱਟ ਹੈ ਮੈਂ ਇਸ ਲਾਈਨ 'ਚ ਨਹੀਂ ਆਉਣ ਜੋਗੀ ਹੈਗੀ ਪਰ ਨਹੀਂ ਮੈਨੂੰ ਇਸ ਲਾਈਨ 'ਚ ਆ ਕੇ ਇੰਨਾ ਵਧੀਆ ਲੱਗਾ ਉਹਨਾਂ ਦੇ ਕਹਿਣ 'ਤੇ ਮੈਂ ਬੀ ਐਡ ਕੀਤੀ ਐੱਮ ਐੱਡ ਕੀਤੀ ਇਸ ਤੋਂ ਬਾਅਦ ਮੈਂ ਐੱਮ ਏ ਸ਼ਸ਼ੋਲੋਜੀ ਕੀਤੀ ਐੱਮ ਏ ਹਿਸਟਰੀ ਕੀਤੀ ਅਤੇ ਅੱਜ ਕਿ ਮੈਂ ਬੜੇ ਅੱਛੇ ਮੁਕਾਮ 'ਤੇ ਹਾਂ ਮੈਂ ਅੱਜ ਕੇ ਸੀ ਕੋਲਜ ਆਫ ਐਜੂਕੇਸ਼ਨ 'ਚ ਅਸਿਸਟੈਂਟ ਪ੍ਰੋਫੈਸਰ ਹਾਂ ਇਹਦੇ ਲਈ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਆਪਣੇ ਪਤੀ ਦੀ ਆਪਣੀ ਸੱਸ ਮਾਂ ਦੀ ਜਿ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਇਸ ਮੁਕਾਮ 'ਤੇ ਆਈ ਹਾਂ ਅਤੇ ਮੈਨੂੰ ਬਹੁਤ ਅੱਛਾ ਮਹਿਸੂਸ ਹੋ ਰਿਹਾ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਂ ਟੀਚਿੰਗ ਲਾਈਨ ਦੇ ਕਾਬਿਲ ਨਹੀਂ ਹੈਗੀ ਕਿ ਮੇਰੇ 'ਚ ਕਿ ਜਿਹੜਾ ਆਤਮ ਵਿਸ਼ਵਾਸ ਹੈ ਘੱਟ ਹੈ ਪਰ ਨਹੀਂ ਔਰ ਇਸ ਲਾਈਨ 'ਚ ਆ ਕੇ ਮੈਨੂੰ ਮੇਰੇ ਜੋ ਮੇਰੇ ਨਾਲ ਦੇ ਮੇਰੇ ਟੀਚਰਾਂ ਨੇ ਵੀ ਬਹੁਤ ਸਾਥ ਦਿੱਤਾ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਸ਼ਨ ਦਿੱਤੀ ਕਿ ਮੈਂ ਸਟੇਜ 'ਤੇ ਆਈ ਬੱਚਿਆਂ ਨੂੰ ਪੜ੍ਹਾਇਆ ਔਰ ਅੱਜ ਮੈਨੂੰ ਬਹੁਤ ਹੀ ਅੱਛਾ ਫੀਲ ਹੁੰਦਾ ਹੈ ਇਸ ਲਾਈਨ 'ਚ ਆ ਕੇ